ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਜਿਵੇਂ ਗੁਰੂ ਜੀ ਠੀਕ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣਾ ਇਲਾਕਾ ਕਿਹੜਾ ਜੀ ਕਿੱਥੋਂ ਬੋਲ ਰਹੇ ਹੋ

ਕਿੰਨੀ ਉਮਰ ਹੈ ਭੈਣ ਜੀ ਦੀ ਜੀ ਤੇਰਾਂ ਸਾਲ ਦਾ ਹੁਕਮ ਹੋ ਜੇ ਫਿਰ ਪੜ੍ਹਾਉਣਾ ਸੀਗਾ ਜ਼ਿਆਦਾ ਵਧੀਆ ਨਹੀਂ

ਠੀਕ ਹੈ ਜੀ ਵਾਹਿਗੁਰੂ ਜੀ ਗੁਰਬਾਣੀ ਦੀ ਸੰਥਿਆ ਲੈਣੀ ਏ ਜਾਂ ਨਾਲ ਗਤਕਾ ਕੀਰਤਨ ਸਹਿਜ ਪਾਠ ਹੈਗਾ ਠੀਕ ਹੈ ਵਾਹਿਗੁਰੂ ਜੀ ਠੀਕ ਹੈ ਵਾਹਿਗੁਰੂ ਜੀ ਅਤੇ ਜਿਹੜੀ ਵਾਹਿਗੁਰੂ ਜੀ ਇਹਦੇ ਹੁੰਦੇ ਸਕੂਲ ਦਾ ਕਿੱਦਾ ਸਿਸਟਮ ਸੈਟ ਆਏਗਾ ਫਿਰ ਬੱਚਾ ਪੜ੍ਹਦਾ ਨਾ ਹਜੇ ਫਿਰ ਕਿੱਦਾਂ ਸਕੂਲ ਦਾ ਕਿਵੇਂ ਸੈਟਿੰਗ ਆਏਗੀ

ਔਰ ਉਹ ਤਾਂ ਚਲੋ ਸਰਟੀਫਿਕੇਟ ਲੈ ਆਉਣ ਠੀਕ ਹੈ ਐਡਮਿਸ਼ਨ ਕਰਵਾ ਦਵਾਂਗੇ ਨਾਲ ਉਹਨਾਂ ਦੀ ਅਤੇ ਨਾਲ ਨਾਲ ਪੜ੍ਹਾਈ ਅਤੇ ਨਾਲ ਨਾਲ ਗੁਰਬਾਣੀ ਸੰਥਿਆ ਨਾਲ ਨਾਲ ਚੱਲਦੀ ਰਹੇਗੀ

ਠੀਕ ਹੈ ਜੀ ਠੀਕ ਹੈ ਜੀ ਗੁਰਬਾਣੀ ਸੰਥਿਆ ਮਿਲਣੀ ਸ਼ੁਰੂ ਹੋ ਜਾਏਗੀ ਕੋਸ਼ਿਸ਼ ਕਰੋ ਤੁਸੀਂ ਆਹ ਵੀ ਘਰੇ ਪਾਠ ਕਰਿਆ ਕਰੋ ਜਿੰਨੇ ਚਿਰ ਐਡਮਿਸ਼ਨ ਨਹੀਂ ਕਰਾਉਂਦੇ ਗੇ ਤੁਸੀਂ ਖੁਦ ਪਾਠ ਕਰੋ ਘਰੇ ਬੱਚੇ ਨੂੰ ਪਾਠ ਕਰਾਓ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਦੇਖੋ ਜਦੋਂ ਗੁਰਬਾਣੀ ਦੀ ਸੰਥਿਆ ਚੱਲੇਗੀ ਨਾਲ ਨਾਲ ਜਿਹੜੇ ਪਾਸੇ ਬੱਚੇ ਦਾ ਇੰਟਰਸਟ ਹੋਏਗਾ ਨਾ ਜੀ ਉਸੇ ਪਾਸੇ ਨਾਲ ਸੰਥਿਆ ਜਾਏਗੀ ਜਾਏਗੀ ਜੇ ਇਕੱਲੀ ਗੁਰਬਾਣੀ ਦੀ ਸੰਥਿਆ ਲੈਣੀ ਏ ਤਾਂ ਉਹ ਹੋ ਜਾਏਗੀ ਜੇ ਉਹਦੇ ਨਾਲ ਨਾਲ ਕਥਾ ਸਿੱਖਣੀ ਹੈ ਤਾਂ ਕਥਾ ਵੀ ਟ੍ਰੇਨਿੰਗ ਨਾਲ ਚਲਦੀ ਰਹੇਗੀ ਜੇ ਉਹਨਾ ਦਾ ਇੰਟਰਸਟ ਗਤਕੇ ਵਾਲੇ ਪਾਸੇ ਹੈ ਤਾਂ ਗਤਕੇ ਦੀ ਚੱਲ ਜਾਏਗੀ ਇਹ ਦੇਖੋ ਬੱਚੇ ਡਿਪੈਂਡ ਕਰਦਾ ਜਿਹੜੇ ਪਾਸੇ ਬੱਚੇ ਦਾ ਇੰਟਰਸਟ ਹੋਏਗਾ ਜ਼ਿਆਦਾ ਤਾਂ ਉਸੇ ਪਾਸੇ ਹੀ ਉਹਨੂੰ ਭੇਜਿਆ ਜਾਵੇਗਾ ਜੇ ਉਹ ਕਥਾਵਾਚਕ ਬਣਨਾ ਚਾਹੁੰਦਾ ਕਥਾਵਾਚਕ ਬਣ ਸਕਦਾ ਔਰ ਸਾਡੇ ਕੋਲ ਹਰੇਕ ਤਰ੍ਹਾਂ ਦਾ ਇੱਥੇ ਟੀਚਰ ਅਵੇਲੇਵਲ ਏ ਜੋ ਗੁਰਬਾਣੀ ਦੀ ਸੰਥਿਆ ਦਿੰਦੇ ਨੇ ਜੀ ਹੋਰ ਸੇਵਾ ਜੀ ਹਾਂ ਕੋਈ ਗੱਲ ਨਹੀਂ ਜਦੋਂ ਤੁਸੀਂ ਮਰਜ਼ੀ ਬੱਚੇ ਨੂੰ ਲੈ ਆਓ ਅਤੇ ਕੋਸ਼ਿਸ਼ ਕਰੋ ਜਿੰਨਾਂ ਚਿਰ ਤੁਸੀਂ ਨਹੀਂ ਲੈ ਕੇ ਆਉਂਦੇ ਉਨਾਂ ਚਿਰ ਬੱਚੇ ਨੂੰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਭੇਜੋ ਗੁਰਦੁਆਰੇ ਗ੍ਰੰ ਦੇ ਗ੍ਰੰਥੀ ਸਿੰਘ ਤੋਂ ਪਾਠ ਸਿੱਖੇ ਉਨਾਂ ਚਿਰ ਜੇਕਰ ਗੁਰਦੁਆਰੇ ਗੁਰੂ ਦਾ ਸੇਵਕ ਹਾਜਰੀ ਭਰਦਾ ਉੱਥੇ ਕੀਰਤਨ ਸਿਖਾਉਂਦਾ ਤਾਂ ਕੀਰਤਨ ਸਿੱਖਣ ਦੀ ਕੋਸ਼ਿਸ਼ ਕਰੇ ਬਾਕੀ ਗੁਰਦੁਆਰਾ ਸਾਹਿਬ ਭੇਜਿਆ ਕਰੋ ਉੱਥੇ ਪਾਠ ਕਰਿਆ ਕਰੇ ਗੁਰਦੁਆਰੇ ਗ੍ਰੰਥੀ ਸਿੰਘ ਤੋਂ ਨਜਰ ਸੰਥਿਆ ਲਵੇ ਜਿੰਨਾਂ ਚਿਰ ਤੁਸੀਂ ਇੱਥੇ ਨਹੀਂ ਭੇਜਦੇ ਠੀਕ ਹੈ ਜੀ ਚਲੋ ਕੋਈ ਨਹੀਂ ਗੁਜਰਾ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਨਾ ਜੀ ਗੁਰਦੁਆਰੇ ਦੇ ਗ੍ਰੰਥੀ ਸਿੰਘ ਕੋਲ ਭੇਜਿਆ ਕਰੋ ਮਹਾਰਾਜ ਦੇ ਪ੍ਰਕਾਸ਼ ਕਰਨਾ ਸੌਖਾਸਨ ਕਰਨਾ ਗੁਰਬਾਣੀ ਪੜ੍ਹਨੀ ਜਿੰਨਾਂ ਚਿਰ ਇਹਨੂੰ ਸਿੱਖਦਾ ਉਨਾਂ ਸਿਖਾਓ ਅਤੇ ਜੇ ਇੱਥੇ ਆ ਗਏ ਇੱਥੇ ਫਿਰ ਗੁਰੂ ਮਹਾਰਾਜ ਦੀ ਆਪੇ ਕਿਰਪਾ ਹੋ ਜਾਵੇਗੀ ਠੀਕ ਹੈ ਨਾ ਅਤੇ ਬਾਕੀ ਤਾਂ ਬੱਚਾ ਪੜ੍ਹਨ ਵਿੱਚ ਹੁਸ਼ਿਆਰ ਬੱਚਾ ਕਿ ਕਿਵੇਂ ਆ ਚਲੋ ਕੋਈ ਗੱਲ ਨਹੀਂ ਮਾਲਕ ਕਿਰਪਾ ਕਰੇ ਅਤੇ ਕੋਈ ਗੱਲ ਨਹੀਂ ਤੁਸੀਂ ਬੱਚਿਓ ਸਕੂਲ ਸਰਟੀਫਿਕੇਟ ਲਓ ਅਤੇ ਜਦੋਂ ਮਰਜ਼ੀ ਇੱਕ ਵਾਰੀ ਆ ਕੇ ਜਦੋਂ ਛੁੱਟੀ ਹੋਏਗੀ ਨਾ ਸਕੂਲੋਂ ਇੱਕ ਵਾਰੀ ਆ ਕੇ ਮਿਲ ਜਾਣਾ ਤੁਹਾਨੂੰ ਸਾਰਾ ਇੱਥੇ ਸਮਝਾ ਦਿਆਂਗੇ ਜਦੋਂ ਜਦੋਂ ਮਰਜ਼ੀ ਸ਼ੁਰੂ ਕਰ ਸਕਦੇ ਜੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ